ਜਿਵੇਂ ਕਿ ਅਸੀਂ ਜਾਣਦੇ ਹਾਂ ਪੰਜਾਬ ਵਿੱਚ ਜ਼ਿਆਦਾਤਰ ਸਿੱਖ ਧਰਮ ਦੇ ਲੋਕ ਮਜਿਓਰਟੀ ਵਿਚ ਪਾਏ ਜਾਂਦੇ ਨੇ ਹਿੰਦੂ ਧਰਮ ਵੀ ਮਜਿਓਰਟੀ ਵਿੱਚ ਹੈ ਹਿੰਦੂ ਧਰਮ ਦੇ ਲੋਕ ਵੀ ਦੀ ਆਪਾਂ ਗੱਲ ਕਰੀਏ ਕਿ ਹਿੰਦੂ ਮੁਸਲਿਮ ਔਰ ਈਸਾਈ ਲੋਕ ਨੇ ਜੋ ਉਹ ਮਨੋਰਟੀ ਵਿੱਚ ਪਾਏ ਜਾਂਦੇ ਨੇ ਪੰਜਾਬ ਵਿਚ ਪਰ ਕਦੀ ਵੀ ਇਹ ਨਹੀਂ ਹੁੰਦਾ ਕਿ ਜਿਵੇਂ ਕਿਸੇ ਗੁਰਦੁਆਰੇ ਵਿਚ ਜਾਂ ਮੰਦਰ ਮਸਜਿਦ ਵਿੱਚ ਮਨਾਹੀ ਕੀਤੀ ਜਾਂਦੀ ਕਿ ਕੋਈ ਸਪੈਸਫਿਕ ਧਰਮ ਦਾ ਬੰਦਾ ਹੀ ਇਸ ਮੰਦਰ ਵਿੱਚ ਗੁਰਦੁਆਰੇ ਵਿੱਚ ਆ ਸਕਦਾ ਹੈ ਕੋਈ ਮਨਾਹੀ ਨਹੀਂ ਹੁੰਦੀ ਕਿਸੇ ਵੀ ਧਰਮ ਦੇ ਇਨਸਾਨ ਨੂੰ ਕੋਈ ਵੀ ਆ ਜਾ ਸਕਦਾ ਆ ਅਤੇ ਸਾਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਆ ਕਿ ਜਿਵੇਂ ਵੀ ਕੋਈ ਵੀ ਜ ਕੋਈ ਜਿਸ ਤਰ੍ਹਾਂ ਕੋਈ ਗੁਰਪੁਰਬ ਹੁੰਦਾ ਆ ਜਿਸ ਤਰ੍ਹਾਂ ਉਸ ਨੂੰ ਪੰਜਾਬ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਉਸੇ ਹੀ ਤਰੀਕੇ ਨਾਲ ਈਸਾਈਆਂ ਦਾ ਜਿਵੇਂ ਕ੍ਰਿਸਮਿਸ ਹੁੰਦਾ ਆ ਕਰਿਸ਼ਚਨ ਦਾ ਕ੍ਰਿਸਮਿਸ ਹੁੰਦਾ ਆ ਓ ਉਹ ਵੀ ਉਸ ਤਿਉਹਾਰ ਨੂੰ ਵੀ ਹਰ ਧਰਮ ਦੇ ਨਾਲ ਰਿਲੇਟ ਕਰਕੇ ਹਰ ਕੋਈ ਬਹੁਤ ਅੱਛੇ ਤਰੀਕੇ ਨਾਲ ਉਸ ਤਿਉਹਾਰ ਨੂੰ ਮਨਾਉਂਦਾ ਆ ਅਤੇ ਸਾਰਿਆਂ ਨੂੰ ਇੱਕ ਕਦੀ ਕਿਸੇ ਨੂੰ ਇਹ ਕ੍ਰੀਟੀਸਿਜਮ ਕੁਛ ਇਹੋ ਜਿਹੀ ਚੀਜ਼ ਵੇਖਣ ਨੂੰ ਨਹੀਂ ਮਿਲਦੀ ਕਿ ਸਾਨੂੰ ਕੋਈ ਭੇਦਭਾਵ ਦਾ ਕੋਈ ਇਹੋ ਜਿਹਾ ਧ ਨਹੀਂ ਹੈਗਾ ਕਿ ਕੋਈ ਵੀ ਕਿਸੇ ਨਾਲੋਂ ਘੱਟ ਜਾਂ ਕੋਈ ਧਰਮ ਕਿਸੇ ਨਾਲੋਂ ਵੱਧ ਹਮੇਸ਼ਾ ਕੀ ਕਿਹਾ ਜਾਂਦਾ ਹੈ ਕਿ ਪਰਮਾਮਾ ਇੱਕ ਹੀ ਹੈ ਬਸ ਉਸਦੇ ਰੂਪ ਅਲੱਗ ਅਲੱਗ ਹਨ ਹਰ ਇੱਕ ਦਾ ਤਿਉਹਾਰ ਹਰ ਇੱਕ ਦਾ ਧਰਮ ਆਪਣੇ ਆਪ ਵਿਚ ਬਹੁਤ ਵਧੀਆ ਹੈ